ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰੁਣ ਕੁਮਾਰ ਹੈ ਮੈਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਹਿਣ ਵਾਲਾ ਹਾਂ ਮੈਨੂੰ ਜੇ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਇੱਕ ਬਾਈਕਰ ਵਜੋਂ ਤੁਸੀਂ ਕਿਹੜੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਤੁਸੀਂ ਉਹਨਾਂ ਨੂੰ ਕਿਵੇਂ ਦੂਰ ਕਰਦੇ ਹੋ ਖਰਾਬ ਟਰੈਫਿਕ ਖਰਾਬ ਮੌਸਮ ਖਸਤਾ ਹਾਲ ਸੜਕਾਂ ਤੰਗ ਸੜਕਾਂ ਜ਼ਮੀਨ ਖਿਸਕਣਾ ਜੰਗਲੀ ਜਾਨਵਰਾਂ ਆਦਿ ਨਾਲ ਨਜਿੱਠਣ ਲਈ ਤੁਸੀਂ ਕਿਹੜੀ ਕਿਹੜੀ ਸਾਵਧਾਨੀਆਂ ਵਰਤਦੇ ਹੋ ਅਤੇ ਇਸ ਦੇ ਵਿੱਚ ਮੈਂ ਆਸਾਨ ਭਾਸ਼ਾ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਇੱਕ ਬਾਈਕਰ ਵਜੋਂ ਨਾ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਰਾਬ ਟਰੈਫਿਕ ਖਰਾਬ ਮੌਸਮ ਖਸਤਾ ਹਾਲ ਸੜਕਾਂ ਤੰਗ ਰਸਤਾ ਜ਼ਮੀਨ ਖਿਸਕਣਾ ਜੰਗਲੀ ਜਾਨਵਰ ਆਦਿ ਨਾਲ ਨਜਿੱਠਣ ਲਈ ਕਈ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ ਇਹਨਾਂ ਚੁਣੌਤੀਆਂ ਦਾ ਕਿਵੇਂ ਮੁਕਾਬਲਾ ਕੀਤਾ ਜਾ ਸਕਦਾ ਹੈ ਇਹਨਾਂ ਲਈ ਕੁਝ ਸਾਵਧਾਨੀਆਂ ਅਤੇ ਐਸੇ ਤਰੀਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਵੇਂ ਕਿ ਖਰਾਬ ਟਰੈਫਿਕ ਹੁੰਦਾ ਇਸ ਵਿੱਚ ਸਾਨੂੰ ਸਧਾਰਨ ਤੌਰ 'ਤੇ ਸਲੋਅ ਚੱਲਣਾ ਚਾਹੀਦਾ ਜਦੋਂ ਵੀ ਟਰੈਫਿਕ ਗਾਰਾ ਹੁੰਦਾ ਹੈ ਅਤੇ ਸਾਨੂੰ ਜ਼ਿਆਦਾ ਰਫਤਾਰ ਨਾਲ ਨਹੀਂ ਚੱਲਣਾ ਚਾਹੀਦਾ ਸਾਨੂੰ ਸ ਜ਼ਰੂਰੀ ਸਿਗਨਲ ਜਿਹੜੇ ਹੁੰਦੇ ਹਨ ਟਰੈਫਿਕ ਨਿਯਮ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਰਾਹ 'ਤੇ ਸਾਨੂੰ ਨਾ ਸਾਫ ਇਸ਼ਾਰਿਆਂ ਦੀ ਵਰਤੋਂ ਕਰਨੀ ਚਾਹੀਦੀ ਜਿਵੇਂ ਕਿ ਜੇ ਲੈਫਟ ਜਾਂ ਰਾਈਟ ਮੋੜਦੇ ਸਮੇਂ ਨਾ ਸਾਨੂੰ ਹੱਥਾਂ ਨਾਲ ਇਸ਼ਾਰਾ ਕਰਕੇ ਸਹੀ ਰਸਤਾ ਦਿਖਾਉਣਾ ਚਾਹੀਦਾ ਜੇਕਰ ਖਰਾਬ ਮੌਸਮ ਹੁੰਦਾ ਹੈ ਉਸ ਵਿੱਚ ਕਿ ਸਾਨੂੰ ਬਾਹਰ ਜਾਣ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ ਬਾਹਰ ਜ ਜਲਦੀ ਰੁਕੋ ਅਤੇ ਜ਼ਰੂਰੀ ਹੋਵੇ ਜੇ ਕਿ ਮੰਨ ਲਓ ਸਾਨੂੰ ਨਾ ਮੌਸਮ ਬਹੁਤ ਖਰਾਬ ਹੋਵੇ ਅਤੇ ਸਾਨੂੰ ਨਾ ਸੁਰੱਖਿਅਤ ਕੋਈ ਵਧੀਆ ਜਿਹਾ ਥਾਂ ਲੱਭ ਕੇ ਨਾ ਉੱਥੇ ਰੁਕ ਜਾਣਾ ਚਾਹੀਦਾ ਹੈ ਬਾਹਰ ਜਾਣ ਤੋਂ ਪਹਿਲਾਂ ਖਰਾਬ ਮੌਸਮ ਵਿੱਚ ਸਾਨੂੰ ਬਾਰਿਸ਼ ਜਾਂ ਬਰਫ ਵਿੱਚ ਸਫਰ ਕਰਨ ਲਈ ਹਮੇਸ਼ਾ ਵਾਟਰਪਰੂਫ ਕੱਪੜੇ ਪਹਿਨਣੇ ਚਾਹੀਦੇ ਨੇ ਜੋ ਕਿ ਖਸਤਾ ਹਾਲ ਸੜਕਾਂ ਹਨ ਸਾਨੂੰ ਉੱਤੇ ਨਾ ਧੀਰੇ ਚੱਲਣਾ ਚਾਹੀਦਾ ਖਸਤਾ ਹਾਲ ਸੜਕਾਂ 'ਤੇ ਹਮੇਸ਼ਾ ਜ਼ਿਆਦਾ ਰਫਤਾਰ ਨਾਲ ਨਹੀਂ ਚੱਲਣਾ ਚਾਹੀਦਾ ਜੋ ਕਿ ਤੰਗ ਸੜਕਾਂ ਵਾ ਉਸ 'ਤੇ ਕੀ ਆਪਾਂ ਕਿ ਤੰਗ ਸੜਕਾਂ 'ਤੇ ਨਾ ਹੌਲੀ ਚੱਲਣਾ ਚਾਹੀਦਾ ਅਤੇ ਦੂਸਰੇ ਵਾਹਨਾਂ ਨੂੰ ਨਾ ਹਮੇਸ਼ਾ ਕੱਟਨਾ ਚਾਹੀਦਾ ਉਹਨਾਂ ਨੂੰ ਪਹਿਲਾਂ ਘਟਾਉਣਾ ਚਾਹੀਦਾ ਸਾਨੂੰ ਕਿ ਪਹਿਲਾਂ ਉਹ ਚਲੇ ਜਾਣ ਫਿਰ ਆਪਾਂ ਜਾਈਏ ਜੇਕਰ ਜ਼ਮੀਨ ਖਿਸਕਣ ਦੀ ਪ੍ਰੋਬਲਮ ਕਿਤੇ ਆਉਂਦੀ ਹੈ ਅਤੇ ਉਸ ਵਿੱਚ ਕੀ ਸਾਨੂੰ ਕਦੇ ਵੀ ਕਿਸ ਕਦੇ ਪਹਾੜਾਂ ਦੇ ਨਾਲ ਨਹੀਂ ਚੱਲਣਾ ਚਾਹੀਦਾ ਕਿਸੇ ਜ਼ਮੀਨ ਖਿਸਕਣ ਦਾ ਖਤਰਾ ਹੁੰਦਾ ਨਾ ਉੱਥੇ ਹਮੇਸ਼ਾ ਸਫਰ ਕਰਨ ਤੋਂ ਸਾਨੂੰ ਬਚਣਾ ਚਾਹੀਦਾ ਜਦੋਂ ਵੀ ਸਾਨੂੰ ਸੰਭਵ ਹੋ ਜਾਣਾ ਸਾਨੂੰ ਸੁਰੱਖਿਅਤ ਵਧੀਆ ਰਾਹਾਂ 'ਤੇ ਚੋਣ ਕਰਨੀ ਚਾਹੀਦੀ ਹੈ ਜੰਗਲੀ ਜਾਨਵਰਾਂ ਤੋਂ ਬਚਣ ਲਈ ਸਾਨੂੰ ਕਹਿੰਦੇ ਜੰਗਲੀ ਜਾਨਵਰਾਂ ਦੇ ਖੇਤਰਾਂ ਵਿੱਚ ਨਾ ਸਾਵਧਾਨ ਰਹਿਣਾ ਚਾਹੀਦਾ ਹਮੇਸ਼ਾ ਉਹਨਾਂ ਦੇ ਜੰਗਲਾਂ ਵਿੱਚ ਰਫਤਾਰ ਘੱਟ ਰੱਖਣੀ ਚਾਹੀਦੀ ਅਤੇ ਸ਼ਾਂਤੀ ਨਾਲ ਚੱਲਣਾ ਚਾਹੀਦਾ ਬਸ ਇਹਨਾਂ ਸਾਵਧਾਨੀਆਂ ਦੇ ਵਰਤ ਕੇ ਨਾ ਅਸੀਂ ਬਾਈਕਰ ਵੱਖ ਵੱਖ ਚੁਣੌਤੀਆਂ ਅਤੇ ਸੁਰੱਖਿਅਤ ਅਤੇ ਸਮਰੱਥ ਤਰੀਕੇ ਨਾਲ ਨਜਿੱਠ ਸਕਦੇ ਹਾਂ ਧੰਨਵਾਦ